ਪਹਿਲਾਂ ਤਾਂ ਸਾਨੂੰ ਇਹ ਚੈੱਕ ਕਰਨਾ ਚਾਹੀਦਾ ਹੈ ਕਿ ਐਲ ਪੀ ਜੀ ਸਿਲੰਡਰ ਦੀ ਜਿਹੜੀ ਪਾਈਪ ਹੈ ਉਹ ਕਿਸੀ ਜਗ੍ਹਾ ਤੋਂ ਲੀਕ ਤਾਂ ਨਹੀਂ ਕਰ ਰਹੀ ਜੇ ਪਾਈਪ ਲੀਕ ਕਰ ਰਹੀ ਹੋਵੇਗੀ ਤਾਂ ਉਸ ਜਗ੍ਹਾ ਤੋਂ ਸਾਨੂੰ ਦੁਰਗੰਧ ਆਉਣੀ ਸ਼ੁਰੂ ਹੋ ਜਾਵੇਗੀ ਅਤੇ ਉਥੋਂ ਸਾਨੂੰ ਪਤਾ ਲੱਗ ਸਕਦਾ ਹੈ ਕਿ ਪਾਈਪ 'ਚ ਕੋਈ ਲੀਕਏਜ ਹੈ ਅਤੇ ਦੂਜੀ ਚੀਜ਼ ਜੋ ਵੀ ਸਲੰਡਰ ਨੂੰ ਪਾਈਪ 'ਤੇ ਲਗਾ ਰਿਹਾ ਹੈ ਉਸ ਨੂੰ ਉਹ ਸਲੰਡਰ ਪਾਈਪ 'ਤੇ ਲਾਉਣਾ ਚੰਗੀ ਤਰ੍ਹਾਂ ਆਉਣਾ ਚਾਹੀਦਾ ਹੈ ਜਿਸ ਨਾਲ ਕੋਈ ਵੀ ਦੁਰਗਟਨਾ ਤੋਂ ਬਚਿਆ ਜਾ ਸਕਦਾ ਹੈ